ਹੈਲੋ ਸਤਿ ਸ਼੍ਰੀ ਅਕਾਲ ਜੀ ਵਧੀਆ ਜੀ ਤੁਸੀਂ ਦੱਸੋ ਸਭ ਵਧੀਆ ਜੀ ਤੁਸੀਂ ਦੱਸੋ ਪਹਿਚਾਣਿਆ ਨਹੀਂ ਜੀ ਕਰਨ ਜਲੰਧਰ ਵਾਲਾ ਜੀ ਅ ਹਾਂ ਅੱਛਾ ਜੀ ਹਾਂਜੀ ਹਾਂਜੀ ਕੋਈ ਨਹੀਂ ਭਾਅ ਜੀ ਕੋਈ ਨਹੀਂ ਤੁਸੀਂ ਇੱਦਾਂ ਸਬਜ਼ੀਆਂ ਵਗੈਰਾ ਕਿੱਥੋਂ ਲੈ ਰਹੇ ਹੋ ਹੁਣ ਸਿਆਲ ਤੋਂ ਅੱਛਾ ਜੀ ਅਤੇ ਭਾਅ ਜੀ ਦੇਖੋ ਹਾਂ ਹੂੰ ਦੱਸੋ ਹਾਂਜੀ ਹਾਂਜੀ ਹਾਂਜੀ ਹਾਂਜੀ ਉਹ ਵੀ ਹੈਗੀ ਆ ਹੁਣ ਥੋੜ੍ਹਾਂ ਕੈਮੀਕਲ ਵਾਲਾ ਹੋ ਗਿਆ ਕੋਈ ਨਹੀਂ ਬਾਈ ਤੁਹਾਨੂੰ ਮੈਂ ਦੱਸੂੰਗਾ ਦੋ ਜਗ੍ਹਾ ਜੀ ਆਪਣੇ ਏਰੀਏ 'ਚ ਜਿਹੜੀਆਂ ਤੁਹਾਡੇ ਨੇੜੇ ਹੀ ਆ ਬਸ ਥੋੜ੍ਹਾਂ ਦੂਰ ਹੈ ਤੁਸੀਂ ਤਾਂ ਸਵੇਰੇ ਜਾਂ ਸ਼ਾਮ ਨੂੰ ਚੱਲ ਜਾਇਓ ਸ਼ਾਮ ਨੂੰ ਤੁਸੀਂ ਛੇ ਕੁ ਵਜੇ ਬਾਅਦ ਛੇ ਤੋਂ ਅੱਠ ਵਜੇ ਬੰਦਾ ਔਰਗੈਨਿਕ ਲਗਾਉਂਦਾ ਜੀ ਅਤੇ ਸਵੇ ਸਵੇਰੇ ਜਿਹੜਾ ਉਹ ਛੇ ਤੋਂ ਸੱਤ ਕਰਦਾ ਘੰਟਾ ਘੰਟਾ ਲਾਉਂਦਾ ਸਵੇਰੇ ਸ਼ਾਮ ਨੂੰ ਦੋ ਘੰਟੇ ਬੈਠਦਾ ਜੀ ਤੁਹਾਡੇ ਤੁਹਾਡੇ ਹਾਂ ਜਿੱਥੇ ਤੁਸੀਂ ਰਹਿੰਦੇ ਹੋ ਨਾ ਤੁਹਾਡੇ ਉੱਥੇ ਤੁਸੀਂ ਬਸ ਕੁਛ ਨਹੀਂ ਹੈ ਤੁਸੀਂ ਜਾ ਕੇ ਵਾਰਡ ਨੰਬਰ ਸੱਤ 'ਤੇ ਜਾਣਾ ਜੀ ਹਾਂਜੀ ਉੱਥੇ ਮਨੀਸ਼ ਜਿਹੜਾ ਔਰਗੈਨਿਕ ਉਹਦਾ ਬੋਰਡ ਵੀ ਲੱਗਿਆ ਵਾ ਇੱਕ ਛੋਟੀ ਮਤਲਬ ਉਹਨੇ ਸ਼ੋਪ ਜਿਹੀ ਲਈ ਵੀ ਰੈਂਟ 'ਤੇ ਹਾਂਜੀ ਅਤੇ ਭਾਅ ਜੀ ਉਹ ਜਿੰਨੇ ਵੀ ਤੁਹਾਡੇ ਬਿਨਾਂ ਐਨ ਔਰਗੈਨਿਕ ਜਿਹੜੀਆਂ ਸਬਜ਼ੀਆਂ ਮਿਲਦੀਆਂ ਅਤੇ ਫਲ ਫਰੂਟ ਵੀ ਜਿਹੜੇ ਉਹਦਾ ਰੇਟ ਥੋੜ੍ਹਾਂ ਜ਼ਿਆਦਾ ਮਿਲੂਗਾ ਤੁਹਾਨੂੰ ਪਰ ਇਹ ਚੀਜ਼ ਤੁਹਾਨੂੰ ਵਧੀਆ ਮਿਲ ਜਾਣੀਆ ਸਰ ਜਿਹੜੀਆਂ ਸਬਜ਼ੀਆਂ ਜਿਹੜੇ ਤੁਹਾਡੇ ਹਾਂ ਹਾਂਜੀ ਨਹੀਂ ਨਹੀਂ ਬਾਈ ਜੀ ਉੱਥੇ ਚੀਜ਼ ਤੁਹਾਨੂੰ ਵਧੀਆ ਮਿਲੇਗੀ ਜੇ ਤਾਂ ਉਸਦੇ ਤੋਂ ਬਾਅਦ ਸਾਡੇ ਇੱਥੇ ਮਤਲਬ ਥੋੜ੍ਹਾਂ ਹੈ ਦੂਰ ਹੈ ਜਿਹਦੇ ਮਤਲਬ ਤੁਹਾਡੀ ਛੁੱਟੀ ਜਿੱਦਾਂ ਹੋ ਗਈ ਜਿੱਦਾਂ ਐਤਵਾਰ ਤੁਹਾਡੀ ਛੁੱਟੀ ਹੋ ਗਈ ਤਾਂ ਤੁਸੀਂ ਇੱਧਰ ਮੇਰੇ ਵੱਲ ਆ ਜਾਇਓ ਮੈਂ ਵਾਰਡ ਨੰਬਰ ਚੌਂਤੀ ਦੇ ਵਿੱਚ ਹਾਂ ਅਤੇ ਮਕਾਨ ਨੰਬਰ ਮੇਰਾ ਪੰਜਾਹ ਹੈ ਜੀ ਤੁਸੀਂ ਇੱਥੇ ਆ ਜਾਇਓ ਮੈਂ ਕਿਉਂਕਿ ਮੈਂ ਨਾ ਹਫ਼ਤੇ 'ਚ ਇੱਕ ਵਾਰ ਲੈਣ ਜਾਂਦਾ ਉਹ ਫਾਰਮ ਹੈ ਮਤਲਬ ਇਥੋਂ ਥੋੜ੍ਹਾ ਜਿਹਾ ਜਿਲ੍ਹੇ ਤੋਂ ਥੋੜ੍ਹਾ ਮਤਲਬ ਪੰਜ ਕਿਲੋਮੀਟਰ ਅਗਾਂਹ ਹੀ ਹੈ ਸਿਟੀ ਦੇ ਮੁੱਕਦੇ ਹੀ ਅਤੇ ਉੱਥੇ ਫਾਰਮ ਹੈ ਅਤੇ ਮੈਂ ਉੱਥੇ ਹੀ ਲੈਣ ਜਾਂਦਾ ਜੀ ਅਤੇ ਆਪਣਾ ਹਫ਼ਤੇ ਦੀ ਸਬਜ਼ੀ ਜਿਹੜੀ ਲਿਆਉਂਦਾ ਅਤੇ ਫਰੈਸ਼ ਰਹਿੰਦੀ ਹੈ ਅਤੇ ਕੋਈ ਚੱਕਰ ਕੰਪਲੇਂਟ ਨਹੀਂ ਹੈ ਹਾਂਜੀ ਜੇ ਤਾਂ ਮਤਲਬ ਤੁਸੀਂ ਹੁਣ ਕਰਨਾ ਬਿਲਕੁਲ ਜੀ ਤਾਜ਼ੀ ਉਹ ਖ਼ੁਦ ਉਹ ਵੀ ਮੇਰਾ ਯਾਰ ਦੋਸਤ ਹੈ ਜੀ ਅਤੇ ਉਹ ਖ਼ੁਦ ਇਹ ਕਹਿੰਦਾ ਕਿ ਖ਼ੁਦ ਤੋਲ ਲਿਆ ਕਰ ਪ ਅਸੀਂ ਖ਼ੁਦ ਆਪਣੇ ਪਸੰਦ ਲਈ ਲੈ ਕੇ ਅਤੇ ਨਾਲ ਫਰੈਸ਼ ਸਬਜ਼ੀ ਹੁੰਦੀ ਘੱਟੋ ਘੱਟ ਉਹ ਸੱਤ ਦਿਨ ਆਰਾਮ ਨਾਲ ਮੇਰੇ ਨਿਕਲ ਜਾਂਦੇ ਅਤੇ ਮੈਂ ਆਰਾਮ ਫਿਰ ਵਾਪਿਸ ਜਾ ਕੇ ਦਵਾਰੇ ਲਿਆ ਲਿਆਉਂਦਾ ਜੀ ਸਬਜ਼ੀ ਹਾਂਜੀ ਹਾਂਜੀ ਬਾਕੀ ਤੁਸੀਂ ਇਹ ਜਿੱਦਣ ਤੁਹਾਡਾ ਕੰਮ 'ਤੇ ਅਗਰ ਤੁਸੀਂ ਸ਼ਨੀਵਾਰ ਸ਼ਾਮ ਨੂੰ ਜਿੱਦਾਂ ਫਰੀ ਹੁੰਦੇ ਜਾਂ ਐਤਵਾਰ ਨੂੰ ਫਰੀ ਹੁੰਦੇ ਤੁਸੀਂ ਮੈਨੂੰ ਐਂ ਕਰਿਓ ਫੋਨ ਕਰ ਲਿਓ ਅਤੇ ਜਾਂ ਤਾਂ ਮੇਰੇ ਤੁਸੀਂ ਹੁਣ ਐਡਰੈੱਸ ਦੇ ਦਿੱਤਾ ਵਾ ਤੁਹਾਨੂੰ ਵਟਸਐਪ 'ਤੇ ਮੈਂ ਤੁਹਾਨੂੰ ਫੁੱਲ ਐਡ੍ਰੈਸ ਸੈਂਡ ਕਰ ਦੂੰਗਾ ਜੀ ਹੈ ਨਾ ਅਤੇ ਤੁਸੀਂ ਮੈਂ ਬਾਅਦ ਚੋਂ ਤਾਂ ਇਕੱਠੇ ਅਸੀਂ ਇਕੱਠੇ ਲੈ ਆਉਂਗੇ ਤੁਹਾਨੂੰ ਮੈਂ ਦੱਸ ਦੂੰਗਾ ਤੁਸੀਂ ਪਿੱਛੇ ਦੇ ਅਗਰ ਪਿੱਛੇ ਦੇ ਅਗਰ ਤੁਸੀਂ ਲੈਣਾ ਹੋਇਆ ਤਾਂ ਤੁਸੀਂ ਲੈ ਕੇ ਆ ਸਕਦੇ ਹੋ ਜੀ ਹਾਂਜੀ ਹੋਰ ਦੱਸੋ ਘਰ ਬਾਰ ਸਭ ਠੀਕ ਹੈ ਜੀ ਹਾਂ ਬਾਕੀ ਕੋਈ ਹੋਰ ਜ਼ਰੂਰਤ ਹੋਈ ਤਾਂ ਦੱਸਿਓ ਮੈਨੂੰ ਕੋਈ ਨਹੀਂ ਠੀਕ ਹੈ ਜੀ ਹਾਂ ਠੀਕ ਹੈ ਜੀ ਓਕੇ ਓਕੇ